ਇੱਕ ਨਵੰਬਰ ਉੱਨੀ ਸੌ ਚੁਰਾਸੀ ਛੇ ਦਸੰਬਰ ਉੱਨੀ ਸੌ ਛਿਆਸੀ ਬਾਰ੍ਹਾਂ ਜਨਵਰੀ ਦੋ ਹਜ਼ਾਰ ਦੋ ਉੱਨੀ ਜੂਨ ਦੋ ਹਜ਼ਾਰ ਚਾਰ ਚਾਰ ਜੁਲਾਈ ਦੋ ਹਜ਼ਾਰ ਤੇਈ